ਅੱਜ ਦੇ ਸਮੇਂ ਵਿੱਚ ਯੂਟਿਊਬ ਚੈਨਲ ਦੇ ਉੱਤੇ ਬਹੁਤ ਸਾਰੇ ਇਹੋ ਜਿਹੇ ਚੈਨਲ ਹਨ ਜੋ ਕਿ ਡਾਂਸ ਨੂੰ ਦਿਖਾਉਂਦੇ ਹਨ ਮਗਰ ਮੇਰਾ ਸਭ ਤੋਂ ਦਾ ਪਸੰਦੀਦਾਰ ਚੈਨਲ ਭੰਗੜਾ ਇੰਪਾਇਰ ਹੈ ਭੰਗੜਾ ਇੰਪਾਇਰ ਦਾ ਚੈਨਲ ਬਹੁਤ ਹੀ ਮਸ਼ਹੂਰ ਹੈ ਇਹ ਆਪਣੇ ਚੈਨਲ ਦੇ ਵਿੱਚ ਭੰਗੜੇ ਨੂੰ ਦਿਖਾਉਂਦੇ ਹਨ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਲਚਕ ਹੈ ਅਤੇ ਇਹ ਬਹੁਤ ਜ਼ਿਆਦਾ ਵਧੀਆ ਭੰਗੜਾ ਕਰਦੇ ਹਨ ਅਤੇ ਸਿਖਾਉਂਦੇ ਹਨ ਇਹ ਹਰ ਹਫ਼ਤੇ ਭੰਗੜੇ ਦੀ ਵੀਡੀਓ ਨੂੰ ਅਪਲੋਡ ਕਰਦੇ ਹਨ ਤਾਂ ਜੋ ਲੋਕ ਵੀ ਇਸ ਦੇ ਥਰੂ ਭੰਗੜਾ ਸਿੱਖਣ ਅਤੇ ਅੱਗੇ ਸਿਖਾਉਣ ਇਹ ਇਕ ਲੋਕ ਨਾਚ ਹੈ ਅਤੇ ਭੰਗੜਾ ਇੰਪਾਇਰ ਵਿੱਚ ਇਹ ਆਪਣੇ ਲੋਕ ਨਾਚ ਨੂੰ ਦਿਖਾਉਂਦੇ ਹਨ ਇਹ ਬਹੁਤ ਜ਼ਿਆਦਾ ਵਧੀਆ ਭੰਗੜਾ ਕਰਦੇ ਹਨ ਅਤੇ ਮੈਂ ਵੀ ਇਹਨਾਂ ਦੇ ਥਰੂ ਹੀ ਇੰਸਪਾਇਰ ਹੋਈ ਹਾਂ ਭੰਗੜਾ ਕਰਨ ਦੇ ਵਾਸਤੇ ਜਦੋਂ ਵੀ ਮੇਰੇ ਕੋਲਜ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਮੈਂ ਇਹਨਾਂ ਦੇ ਵੀਡੀਓ ਹੀ ਦੇਖਦੀ ਹਾਂ ਅਤੇ ਅੱਗੇ ਆਪਣੇ ਦੋਸਤਾਂ ਨੂੰ ਭੰਗੜਾ ਸਿਖਾਉਂਦੀ ਹਾਂ